ਪੰਜਾਬੀ ਭਾਸ਼ਾ ਦੇ ਇਤਿਹਾਸ ਬਾਰੇ ਦੇਖਿਆ ਜਾਵੇ ਤਾਂ ਇਸ ਦੀ ਹੋਂਦ ਬ੍ਰਾਹਮੀ ਲਿਪੀ ਤੋਂ ਨਿਕਲੀ ਹੋਈ ਮੰਨੀ ਜਾਂਦੀ ਹੈ ਪ੍ਰੰਤੂ ਅਸੀਂ ਦੇਖਦੇ ਹਾਂ ਕਿ ਤਕਰੀਬਨ ਬਾਬਾ ਫ਼ਰੀਦ ਦੇ ਸਮੇਂ ਜਾਂ ਕਹਿ ਲਉ ਕਿ ਗਿਆਰਵੀਂ ਸਦੀ ਦੇ ਆਸ ਪਾਸ ਸ਼ੁੱਧ ਪੰਜਾਬੀ ਰੂਪ ਪ੍ਰਚਲਿਤ ਹੋਣ ਲੱਗੇ ਇਸ ਤੋਂ ਇਲਾਵਾ ਵੀ ਜੇ ਦੇਖਿਆ ਜਾਵੇ ਤਾਂ ਸਿੱਧ ਨਾਥ ਜੋਗੀਆਂ ਦਾ ਸਾਹਿਤ ਵੀ ਮਿਲਦਾ ਹੈ ਜੋ ਕਿ ਪੰਜਾਬੀ ਦੀ ਦੱਸ ਪਾਉਂਦਾ ਹੈ ਪ੍ਰੰਤੂ ਜੇਕਰ ਅਸੀਂ ਆਲੋਚਨਾ ਦੇ ਹਿਸਾਬ ਨਾਲ ਦੇਖੀਏ ਤਾਂ ਬਾਬਾ ਫ਼ਰੀਦ ਦੀ ਬਾਣੀ ਨੂੰ ਹੀ ਸ਼ੁੱਧ ਪਜ ਪੰਜਾਬੀ ਭਾਸ਼ਾ ਦੀ ਜਾਈ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ ਪੰਜਾਬੀ ਵਿੱਚ ਬਹੁਤ ਸ਼ੁ ਸ਼ੁੱਧੀਕਰਨ ਹੋਇਆ ਸਮੇਂ ਦੇ ਨਾਲ ਨਾਲ ਇਸ ਦੀਆਂ ਪ੍ਰਵਿਰਤੀਆਂ ਵੀ ਬਦਲਦੀਆਂ ਗਈਆਂ ਪਹਿਲਾਂ ਤਾਂ ਅਸੀਂ ਦੇਖੀਏ ਕਿ ਅਲੱਗ ਅਲੱਗ ਵਿਧਾਵਾਂ ਵਿੱਚ ਪੰਜਾਬੀ ਵਿੱਚ ਸਾਹਿਤ ਰਚਿਆ ਗਿਆ ਸਭ ਤੋਂ ਹਰਮਨ ਪਿਆਰੀ ਵਿਧਾ ਕਵਿਤਾ ਸੀ ਕਵਿਤਾ ਦੀ ਸ਼ੁਰੂਆਤ ਤਾਂ ਬਾਬਾ ਫ਼ਰੀਦ ਜੀ ਤੋਂ ਹੀ ਹੋਈ ਹੈ ਉਹਨਾਂ ਨੇ ਰਹੱਸਵਾਦ ਦੀ ਦੱਸ ਪਾਈ ਹੈ ਇਸ ਤੋਂ ਬਾਅਦ ਜੋ ਚਰਚਿਤ ਕੰਮ ਹੋਇਆ ਹੈ ਉਹ ਗੁਰਮਤਿ ਕਾਵਿ ਵਿੱਚ ਦੇਖਣ ਨੂੰ ਮਿਲਦਾ ਹੈ ਗੁਰਮਤਿ ਕਾਵਿ ਦੇ ਵਿੱਚ ਆਲੇ ਦੁਆਲੇ ਦੇ ਸਾਰੀਆਂ ਪ੍ਰਚਲਿਤ ਧਾਰਨਾਵਾਂ ਨੂੰ ਸ਼ਾਮਿਲ ਕਰਕੇ ਅਤੇ ਉਹਨਾਂ ਦਾ ਖੰਡਨ ਵੀ ਕੀਤਾ ਗਿਆ ਇਸ ਨਾਲ ਚਾਨਣ ਲਿਆਉਣ ਦਾ ਕੰਮ ਕੀਤਾ ਗਿਆ ਇਹ ਸ਼ੁੱਧ ਚੇਤਨਾ ਰੂਪ ਨੂੰ ਪੰਜਾਬੀ ਵਿੱਚ ਸੰਕਲਿਤ ਕਰਨ ਦਾ ਕੰਮ ਸੀ ਇਸ ਤੋਂ ਬਾਅਦ ਸਮਕਾਲੀ ਰੂਪ ਜੇਕਰ ਦੇਖਿਆ ਜਾਵੇ ਤਾਂ ਪੰਜਾਬੀ ਵਿੱਚ ਨਾਮਵਰ ਸ਼ਹਿਰ ਜਿਵੇਂ ਕਿ ਸੁਰਜੀਤ ਪਾਤਰ ਅਮਿਤੋਜ ਹੋਣਾ ਨੇ ਪੰਜਾਬੀ ਵਿੱਚ ਬਹੁਤ ਵਡਮੁੱਲਾ ਯੋਗਦਾਨ ਦਿੱਤਾ ਹੈ